ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਹਾਂਜੀ ਹਾਂਜੀ ਟੇਲਰ ਜੀ ਬੋਲ ਰਹੇ ਓ ਹਾਂਜੀ ਮੈਂ ਨਾ ਮਾਸਟਰ ਜੀ ਮੇਰਾ ਵਿਆਹ ਆ ਅਗਲੇ ਕੁਛ ਦਿਨਾਂ 'ਚ ਅਤੇ ਮੈਂ ਜਿਸ ਤਰ੍ਹਾਂ ਆਪਣੇ ਲਾਵਾਂ ਫੇਰਿਆਂ ਲਈ ਇੱਕ ਜੋ ਆਪਣਾ ਆਪਣਾ ਪੰਜਾਬੀ ਕਲਚਰਲ ਪੰਜਾਬੀ ਇੱਕ ਬਨਵਾਉਣੀ ਸੀ ਮੈਂ ਡਰੈਸ ਹਾਂਜੀ ਹਾਂਜੀ ਸੂਟ ਹੋਜੇ ਵਧੀਆ ਤਾਂ ਤੁਸੀਂ ਥੋੜ੍ਹਾ ਜਿਹਾ ਦੱਸੋਗੇ ਵੀ ਕੀ ਕੁਛ ਹੈ ਤੁਹਾਡੇ ਕੋਲ ਕੋਈ ਆਈਡੀਆਸ ਵਗੈਰਾ ਥੋੜ੍ਹਾ ਜਿਹਾ ਪਤਾ ਲੱਗ ਜੇ ਫਿਰ ਨਹੀਂ ਤੁਸੀਂ ਆਪ ਰੱਖਦੇ ਹੋ ਕੱਪੜਾ ਪਲੇਨ ਬਈ ਸਟੱਫ ਹਾਂ ਚਲੋ ਕੋਈ ਨਹੀਂ ਦੇਖੋ ਕਲਰ ਤਾਂ ਮੈਂ ਜਿਵੇਂ ਲਾਲ ਰੰਗ ਹੀ ਬਨਾਉਣਾ ਤਾਂ ਉਹਦੇ ਵਿੱਚ ਚਲੋ ਮੈਨੂੰ ਕੋਈ ਵਧੀਆ ਵਧੀਆ ਸਟੱਫ ਮਿਲ ਜਾਏ ਹਾਂਜੀ ਅਤੇ ਉਸ ਹਾਂ ਹਾਂ ਹਾਂ ਹਾਂ ਹਾਂ ਚਲੋ ਮੈਂ ਰੰਗ ਤੁਹਾਨੂੰ ਵੀ ਕਲੀਅਰ ਕਰਤਾ ਵੀ ਮੈਨੂੰ ਲਾਲ ਹੀ ਚਾਹੀਦਾ ਅਤੇ ਉਹਦੇ ਵਿੱਚ ਜੋ ਵੀ ਤੁਹਾਡੇ ਕੋਲ ਫਿਰ ਸਟੱਫ ਹੋਏਗਾ ਵੀ ਉਹ ਦੇਖ ਲਵਾਂਗੇ ਜੋ ਵੀ ਮੈਨੂੰ ਪਸੰਦ ਆਇਆ ਅਤੇ ਉਹ ਨਹੀਂ ਮੈਨੂੰ ਥੋੜ੍ਹਾ ਐਂ ਵੀ ਉਹਦੇ 'ਤੇ ਵਰਕ ਵਗੈਰਾ ਵੀ ਹੋ ਵੇਜਾ ਵੀ ਥੋੜ੍ਹਾ ਵਰਕ ਹੋ ਜਾਏਗਾ ਐਂ ਜਿਸ ਨਹੀਂ ਜੀ ਹੈਂਡਵਰਕ ਹੈਂਡਵਰਕ ਜਿਸ ਤਰ੍ਹਾਂ ਸਿੱਪੀ ਮੋਤੀ ਲੱਗਦੇ ਹੈ ਜਾਂ ਤਿੱਲੇ ਦਾ ਵਰਕ ਹੁੰਦਾ ਜੇ ਥੋੜ੍ਹਾ ਉਹ ਸ਼ਾਇਨਿੰਗ 'ਚ ਹੋ ਜਾਏ ਸੂਟ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਤਾਂ ਤੁਸੀਂ ਮਤਲਬ ਕਿ ਉਹਦਾ ਡਿਜ਼ਾਇਨ ਬਣਾਓਗੇ ਘੇਰਾ ਬਣਾਓਗੇ ਚਾਕ ਜਾਂ ਗਲਾ ਕੀ ਮਤਲਬ ਠੀਕ ਹੈ ਜੀ ਠੀਕ ਹੈ ਉਹਦੇ ਵਿੱਚ ਮਤਲਬ ਆ ਚਾਕ ਤਾਂ ਨਹੀਂ ਚਲਦੇ ਹੈ ਨਾ ਘੇਰਾ ਘੇਰਾ ਹੀ ਚਲਦਾ ਇਕੱਲਾ ਅਤੇ ਇੱਕ ਜੋ ਉਹਦੇ ਵਿੱਚ ਉਹ ਕਲੀਆਂ ਪਾਉਂਦੇ ਹੈ ਜਿਵੇਂ ਏ ਸ਼ੇਪ 'ਚ ਉਹਦੇ 'ਤੇ ਹਾਂ ਹਾਂ ਹਾਂ ਚਲੋ ਵੀ ਮੈਂ ਜ਼ਿਆਦਾ ਤਾਂ ਨਹੀਂ ਉਹ ਚੌੜਾ ਏ ਸ਼ੇਪ ਬਨਵਾਉਣਾ ਕਹਿ ਲਓ ਵੀ ਥੋੜ੍ਹਾ ਜਿਹਾ ਤੁਸੀਂ ਉਹਦੀ ਏ ਸ਼ੇਪ ਕਰ ਦਿਆ ਜੇ ਅਤੇ ਬਾਕੀ ਉਹ ਕਲੀਆਂ ਵਿੱਚ ਵੀ ਥੋੜ੍ਹਾ ਤਿੱਲਾ ਵਰਕ ਹੋ ਜਾਏਗਾ ਅਤੇ ਬਾਕੀ ਬਾਜੂ 'ਤੇ ਹਾਂ ਹਾਂ ਦੁਪੱਟੇ ਦਾ ਤੁਸੀਂ ਜਿਵੇਂ ਕੋਈ ਗੋਟਾ ਵਗੈਰਾ ਜਾਂ ਕੋਈ ਵੀ ਕਿਨਾਰੀ ਵਗੈਰਾ ਅੱਛੀ ਜੀ ਉਹਦੇ ਵਰਕ ਦੇ ਨਾਲ ਮੈਚ ਕਰਦੀ ਤੁਸੀਂ ਉਹ ਹਾਂ ਲਗਾ ਦਿਓਗੇ ਵੀ ਉਹ ਵਧੀਆ ਦੁਪੱਟਾ ਵੀ ਤਿਆਰ ਹੋ ਜਾਏ ਨਹੀਂ ਗੋਲਡ ਹੀ ਹੈ ਮੇਰੀ ਚੋਆਇਸ ਤਾਂ ਵੀ ਤੁਸੀਂ ਗੋਲਡਨ ਹੀ ਕਰੋ ਹਾਂਜੀ ਵੀ ਰੈ ਰੈਡ ਉੱਤੇ ਗੋਲਡਨ ਵਰਕ ਹੋਵੇਗਾ ਤਾਂ ਅਤੇ ਇੱਕ ਤੁਸੀਂ ਫਿਰ ਬੋਟਮ 'ਤੇ ਵੀ ਕਰੋਗੇ ਵਰਕ ਹਾਂਜੀ ਹਾਂਜੀ ਹਾਂਜੀ ਪੌਂਚਿਆਂ 'ਤੇ ਵੀ ਅੱਜ ਕੱਲ੍ਹ ਚਲੋ ਚੱਲ ਰਿਹਾ ਰਿਵਾਜ਼ ਇਹਦਾ

ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਵੀ ਦੁਪੱਟਾ ਵਧੀਆ ਰੈਡੀ ਹੋ ਜਾਏ ਤਾਂ ਤੁਸੀਂ ਮੈਨੂੰ ਦੱਸ ਦਓ ਵੀ ਇਹ ਤੁਹਾਡਾ ਵੀ ਪੂਰਾ ਵੀਕ ਹੀ ਖੁੱਲ੍ਹਾ ਹੁੰਦਾ ਵੀ ਤੁਹਾਡਾ ਸ਼ੋਪ ਸੋਮਵਾਰ ਤੋਂ ਅੱਛਾ ਜੀ ਠੀਕ ਹੈ ਜੀ ਠੀਕ ਹੈ ਚਲੋ ਕੋਈ ਗੱਲ ਨਹੀਂ ਜੀ ਮੈਂ ਇੱਕ ਦੋ ਦਿਨਾਂ ਤੱਕ ਕੋਸ਼ਿਸ਼ ਕਰਾਂਗੀ ਆਉਣ ਦੀ ਅਤੇ ਫਿਰ ਮੈਂ ਤੁਹਾਡੇ ਕੋਲ ਆ ਕੇ ਜਿਹੜਾ ਵੀ ਤੁਹਾਡੇ ਕੋਲ ਸਟੱਫ ਪਿਆ ਜੇ ਮੈਨੂੰ ਤੁਹਾਡੇ ਕੋਲੋਂ ਪਸੰਦ ਆ ਗਿਆ ਤਾਂ ਵਧੀਆ ਅਤੇ ਅਗਰ ਮੰਨ ਲਓ ਚਲੋ ਨਹੀਂ ਵੀ ਪਸੰਦ ਆਉਂਦਾ ਤਾਂ ਫਿਰ ਮੈਂ ਤੁਹਾਨੂੰ ਆਪ ਕੱਪੜਾ ਲੈ ਕੇ ਦੇ ਦੇਵਾਂਗੀ ਠੀਕ ਹੈ ਅਤੇ ਬਾਕੀ ਵਰਕ ਵਗੈਰਾ ਵੀ ਫਿਰ ਮੈਂ ਤੁਹਾਨੂੰ ਆਪਣੀ ਜੋ ਵੀ ਹੈ ਡਿਟੇਲਸ ਮੈਂ ਤੁਹਾਨੂੰ ਦੱਸ ਦਵਾਂਗੀ ਵੀ ਕਿਸ ਕਿਸ ਤਰ੍ਹਾਂ ਕਰਨਾ ਹੈ ਅਤੇ ਬਾਕੀ ਤਾਂ ਚਲੋ ਹਾਂ ਬਾਕੀ ਚਲੋ ਸਟਿਚਿੰਗ ਹੈ ਤਾਂ ਉਹਦਾ ਫਿਰ ਤੁਸੀਂ ਆਪ ਕਰੋਗੇ ਹੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਸ ਚਲ ਆ ਈ ਹੈ ਵੀ ਚਲੋ ਮੈਂ ਆਪਣੇ ਵਿਆਹ 'ਤੇ ਪਾਉਣਾ ਤਾਂ ਵੀ ਚਲੋ ਕੰਮ ਵਧੀਆ ਹੋਵੇ ਤਾਂ ਚਲੋ ਵਧੀਆ ਲੱਗਦਾ ਆਪਾਂ ਨੂੰ ਹਾਂ ਹਾਂ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਓਕੇ